ਭੰਗੜਾ ਪਾਉਣ ਲਈ ਆਮ ਤੌਰ 'ਤੇ ਕੁੜਤਾ ਚਾਦਰਾ ਤੁਰਲੇ ਵਾਲੀ ਪੱਗ ਦੀ ਜਾਨ ਖਾਲੀ ਜੁੱਤੀ ਸਬੰਧੀ ਇਹ ਇਸ ਲਈ ਧਮਾਲ ਲੁੱਡੀ ਝੂਮਰ ਪਾਏ ਜਾਂਦੇ ਹਨ ਇਸ ਸਟੈਪ ਪੰਜਾਬੀਆਂ ਦਾ ਸੁਭਾਵਾਂ ਵਾਂਗ ਜੋਰ ਵਾਲੀ ਅਤੇ ਖੁੱਲ੍ਹੇ ਡੁੱਲ੍ਹੇ ਹਨ ਇਹ ਤੁਹਾਡੇ ਪੰਜਾਬੀਆਂ ਦੀ ਸੁਭਾਅ ਨੂੰ ਪੇਸ਼ ਕਰਦੇ ਹਨ